ਮੇਰੀ ਲਾਈਫ ਦੇ ਵਿੱਚ ਹੈ ਨਾ ਮਤਲਬ ਬਹੁਤ ਘੱਟ ਐਕਸਪੀਰੀਅੰਸ ਜੋ ਮੈਂ ਇਕੱਲੀ ਨਾਲ ਕਤ ਇਕੱਲੀ ਕਿੱਤੇ ਗਈ ਹੋਵਾਂ ਬਟ ਹਾਂ ਇੱਕ ਇੱਕ ਸਾਲ ਪਹਿਲਾਂ ਮੈਂ ਨਾ ਮਤਲਬ ਸ਼ਿਮਲੇ ਗਈ ਸੀ ਮਤਲਬ ਮੈਂ ਕਿਸੇ ਫਰੈਂਡ ਦੇ ਨਾਲ ਨਹੀਂ ਗਈ ਸੀਗੀ ਫਰੈਂਡ ਨੂੰ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ ਅਤੇ ਨਾ ਹੀ ਮਤਲਬ ਮੈਂ ਕਿਸ ਮੈਂ ਆਪਣੇ ਫੋਨ ਨਾਲ ਲੈ ਕੇ ਗਏ ਸੀ ਬਟ ਹਾਂ ਮੇਰੇ ਘਰਦਿਆਂ ਨੂੰ ਪਤਾ ਸੀਗਾ ਕਿ ਹਾਂ ਮੈਂ ਸ਼ਿਮਲੇ ਜਾਣਾ ਹੈ ਅਤੇ ਜਦੋਂ ਮਤਲਬ ਜ ਉਦੋਂ ਨਾ ਜਦੋਂ ਮੈਂ ਸਵੇਰੇ ਗਈ ਸੀ ਪੰਜ ਪੰ ਪੰਜ ਕੁ ਵਜੇ ਗਈ ਸੀਗੀ ਸਵੇਰੇ ਅਤੇ ਪੰਜ ਵਜੇ ਮਤਲਬ ਕਾਫੀ ਮਤਲਬ ਮੀਂਹ ਵਗੈਰਾ ਪੈ ਰਿਹਾ ਸੀਗਾ ਮਤਲਬ ਬੱਸ ਬੱਸ 'ਚ ਅਸੀਂ ਜਦੋਂ ਬੈਠੇ ਸੀਗੇ ਬੱਸ 'ਚ ਮੈਂ ਬੈਠੀ ਸੀ ਅਤੇ ਬੱਸ ਵਿੱਚ ਫਿਰ ਕਾਫੀ ਵਧੀਆ ਸਫਰ ਰਿਹਾ ਨਾ ਉੱਥੇ ਤੱਕ ਦਾ ਮਤਲਬ ਕਾਫੀ ਟਾਈਮ ਮਤਲਬ ਜਦੋਂ ਪੁੱਜੇ ਉੱਥੇ ਅਤੇ ਅਸੀਂ ਸਿੱਕੇ ਮੈਂ ਸਿੱਕੇ ਹੋਟਲ ਵਿੱਚ ਰੁਕੀ ਨਾ ਉੱਥੇ ਮਤਲਬ ਕਾਫੀ ਵਧੀਆ ਸੀਗਾ ਅਤੇ ਉਹ ਹੋਟਲ ਵੀ ਕਾਫੀ ਵਧੀਆ ਸੀ ਜਿੱਥੇ ਮੈਂ ਰੁਕੀ ਮਤਲਬ ਜਿਸ ਜਿਹੜਾ ਮੇਰਾ ਰੂਮ ਸੀਗਾ ਉਹ ਵੀ ਉਹ ਵੀ ਕਾਫੀ ਵਧੀਆ ਸੀਗਾ ਅਤੇ ਰੂਮ ਦੇ ਵਿੱਚ ਕਾਫੀ ਵਧੀਆ ਸ਼ੀਸ਼ਾ ਵਧੀਆ ਸੀਗਾ ਹਰ ਇੱਕ ਚੀਜ਼ ਵਧੀਆ ਸੀਗੀ ਮਤਲਬ ਖਾਣ ਪੀਣ ਨੂੰ ਵੀ ਵਧੀਆ ਸੀ ਕਿਉਂਕਿ ਉੱਥੇ ਮੈਂ ਕਾਫੀ ਇੰਜੋਏ ਕੀਤਾ ਇਕੱਲੀ ਨੇ ਅਤੇ ਉੱਥੇ ਫਿਰ ਉਸ ਤੋਂ ਬਾਅਦ ਅਸੀਂ ਐਕਟੀਵਿਟੀਜ਼ ਕੀਤੀਆਂ ਮੈਂ ਜੇ ਮੈਂ ਬੈਲੂਨ ਵਗੈਰਾ ਨਾਲ ਐਕਟੀਵਿਟੀ ਕਰਨੀ ਹੈਨਾ ਅਤੇ ਉੱਥੇ ਕ ਕਾਫੀ ਕੁਛ ਸਿੱਖਿਆ ਵੀ ਆ ਅਤੇ ਉਸ ਤੋਂ ਬਾਅਦ ਮੈਂ ਮਤਲਬ ਬਰਫ ਦੇ ਗੋਲੇ ਵਗੈਰਾ ਬਣਾ ਕੇ ਹੈ ਨਾ ਮਤਲਬ ਉਹਦੇ ਨਾਲ ਉਹਦੇ ਨਾਲ ਵੀ ਖੁਦ ਇਨਜੋਏ ਕੀਤਾ ਮਤਲਬ ਮੇਰੀ ਲਾਈਫ ਦੇ ਵਿੱਚ ਕਦੇ ਇੱਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਸੀ ਜਿਹੜਾ ਮੈਂ ਇਕੱਲੀ ਨੇ ਜਾ ਕੇ ਕੀਤਾ ਹੈ ਨਾ ਅਤੇ ਕਾਫੀ ਵਧੀਆ ਰਿਹਾ ਉੱਥੇ ਤਾਂ ਸਾਰਾ ਕੁਛ